ਬਰਤਨ ਧੋਣ ਦੀ ਪ੍ਰਕਿਰਿਆ ਵੀ ਵੱਖ ਵੱਖ ਤਰੀਕੇ ਨਾਲ ਹੁੰਦੀ ਹੈ ਜਿਵੇਂ ਪੁਰਾਣੇ ਸਮਿਆਂ ਵਿੱਚ ਬਰਤਨ ਦੀ ਥਿੰਦਿਆਈ ਜਾਂ ਤੇਲ ਵਾਲੀਆਂ ਬਰਤਨਾਂ ਨੂੰ ਸੁਖੀ ਸਵਾਹ ਨਾਲ ਮਾਂਜਿਆ ਜਾਂਦਾ ਸੀਗਾ ਫਿਰ ਉਹਨੂੰ ਸੁੱਕੇ ਕੱਪੜੇ ਨਾਲ ਸਾਫ ਕੀਤਾ ਜਾਂਦਾ ਸੀ ਜਿਹਦੇ ਨਾਲ ਤੇਲ ਧਿਦਿਆਈ ਜਿੰਨੀ ਵੀ ਹੁੰਦੀ ਸੀ ਉਹ ਸਾਰੀ ਲੱਥ ਜਾਂਦੇ ਸੀ ਪਰ ਅੱਜ ਦੇ ਸਮੇਂ ਵਿੱਚ ਲੋਕਾਂ ਨੂੰ ਸਮੇਂ ਦੀ ਪੂਰੀ ਘਾਟ ਹੋਣ ਕਰਕੇ ਬਰਤਨ ਨੂੰ ਪਾਣੀ ਨਾਲ ਹੀ ਧੋਤਾ ਜਾਂਦਾ ਹੈ ਤੇ ਤੇਲ ਜਾਂ ਧੰਦਿਆਈ ਲਾਉਣ ਲਈ ਅਸੀਂ ਪਹਿਲਾਂ ਬਰਤਨਾਂ ਨੂੰ ਇੱਕ ਵਾਰੀ ਪਹਿਲਾਂ ਪਾਣੀ ਨਾਲ ਧੋਨੇ ਹਨ ਤਾਂ ਕਿ ਉਹਦੀ ਜਿੰਨੀ ਵੀ ਜੂਠ ਹੈ ਉਹ ਚੰਗੀ ਤਰ੍ਹਾਂ ਲੱਥ ਜਾਵੇ ਫਿਰ ਉਸ ਤੋਂ ਬਾਅਦ ਆਪਾਂ ਗਰਮ ਪਾਣੀ ਦੀ ਜੇ ਜਿਆਦਾ ਤੇਲ ਵਾਲੇ ਭਾਂਡੇ ਹਨ ਤੇ ਉਹਨੂੰ ਆਪਾਂ ਪਹਿਲਾਂ ਗਰਮ ਪਾਣੀ ਨਾਲ ਸਾਫ ਕੀਤਾ ਜਾਂਦਾ ਫਿਰ ਕਿਸੇ ਅੱਛੇ ਭਾਂਡੇ ਮਾਂਜਣ ਵਾਲੇ ਸਾਬਣ ਜਾਂ ਲੀਸਾ ਪੂਲ ਦੇ ਨਾਲ ਆਪਾਂ ਉਹਨੂੰ ਸਾਫ ਕਰ ਦੇ ਹਾਂ ਤਾਂ ਕਿ ਧੰਦਿਆਈ ਪੂਰੀ ਤਰਹਾਂ ਲੱਥ ਜਾਵੇ ਫਿਰ ਉਹਨੂੰ ਸਾਫ ਪਾਣੀ ਨਾਲ ਧੋ ਕੇ ਨੁਚੜਨੇ ਰੱਖ ਦਿੰਨੇ ਹਨ ਜਿਹਦੇ ਨਾਲ ਉਹਦਾ ਸਾਰਾ ਪਾਣੀ ਨੁਚੜ ਜਾਵੇ ਤੇ ਫਿਰ ਜਦੋਂ ਸੁੱਕ ਜਾਂਦੇ ਹਨ ਭਾਂਡੇ ਤੇ ਫਿਰ ਆਪਾਂ ਉਹਨੂੰ ਸਟੈਂਡ ਤੇ ਲਾ ਦਿੰਦੇ ਹਾਂ ਜਿੰਹਦੇ ਨਾਲ ਬਰਤਨਾਂ ਦੀ ਸਾਰੀ ਥਿੰਦਿਆ ਈ ਪੂਰੀ ਤਰ੍ਹਾਂ ਨਾਲ ਲੱਥ ਜਾਂਦੀ ਹੈ ਅੱਜ ਕੱਲ ਜਿਵੇਂ ਜਿਵੇਂ ਇਹਨਾਂ ਮਾਡਰਨ ਯੁੱਗ ਆ ਚੁੱਕਿਆ ਹੈ ਬਹੁਤ ਸਾਰੇ ਇਹੋ ਜਿਹੇ ਭਾਂਡੇ ਮੰਜਣ ਵਾਲੇ ਸਾਬਣ ਆ ਚੁੱਕੇ ਹਨ ਜਿਹਦੇ ਵਿੱਚ ਨਿੰਬੂ ਸੱਤ ਹੁੰਦਾ ਹੈ ਜਿਹਦੇ ਕਰਕੇ ਧੰਦਿਆਈ ਲਾਉਣ ਚ ਸਾਨੂੰ ਕੋਈ ਜਿਆਦਾ ਪ੍ਰੋਬਲਮ ਨਹੀਂ ਆਉਂਦੀ ਇਸੇ ਤਰ੍ਹਾਂ ਆਪਾਂ ਬੜੀ ਚੰਗੇ ਤਰੀਕੇ ਨਾਲ ਬਰਤਨਾਂ ਚੋਂ ਤੇਲ ਵਾਲੇ ਭਾਂਡੇ ਜਿਹੜੀ ਹੁੰਦੀ ਤੇ ਦਿਆਈ ਪੂਰੀ ਤਰਹਾਂ ਉਤਾਰ ਸਕਦੇ ਹਨ ਵੈਸੇ ਬਰਤਨ ਜਦੋਂ ਆਪਾਂ ਗਰਮ ਪਾਣੀ ਨਾਲ ਧੋਨੇ ਹਾਂ ਤੇ ਅੱਧੇ ਤੋਂ ਜਿਆਦਾ ਥਿੰਦਿਆਈ ਦਾ ਵੈਸੇ ਹੀ ਲੱਥ ਜਾਂਦੀ ਹੈ

ਤਾਂ ਇਸੇ ਤਰ੍ਹਾਂ ਆਪਾਂ ਸਭ ਤੋਂ ਬੈਸਟ ਤਰੀਕਾ ਜਿਹੜਾ ਉਹ ਹੁੰਦਾ ਹੈ ਉਹ ਹੈ ਗਰਮ ਪਾਣੀ ਨਾਲ ਆਪਾਂ ਜਦੋਂ ਭਾਂਡਿਆਂ ਨੂੰ ਸਾਫ ਕਰਦੇ ਹਾਂ ਤੇ ਉਹਦੇ ਨਾਲ ਸੁਭਾਵਿਕ ਤੌਰ ਤੇ ਪੂਰੀ ਤਰ੍ਹਾਂ ਨਾਲ ਧੰਦਿਆਈ ਲੱਥ ਜਾਂਦੀ ਹੈ